ਮੇਰਾ ਇਸ ਸਵਾਲ ਦਾ ਇਹ ਜਵਾਬ ਮੈਂ ਦੇਣਾ ਚਾਹੁੰਦੀ ਹਾਂ ਕਿ ਸਾਨੂੰ ਆਪਣਾ ਵਾਤਾਵਰਨ ਸਾਫ ਰੱਖਣਾ ਚਾਹੀਦਾ ਹੈ ਜੇਕਰ ਆਪਣਾ ਆਪਣਾ ਵਾਤਾਵਰਨ ਸਾਫ ਰੱਖਦੇ ਹਨ ਤਾਂ ਸਾਨੂੰ ਸਾਡੇ ਸਾਡੇ ਇਸ ਵਿੱਚ ਸਾਡਾ ਹੀ ਫਾਇਦਾ ਹੈ ਜੇਕਰ ਅਸੀਂ ਆਪਣਾ ਵਾਤਾਵਰਨ ਸਾਫ ਰੱਖਦੇ ਹਾਂ ਜਿਸ ਤਰੀਕੇ ਨਾਲ ਅਸੀਂ ਆਪਣਾ ਘਰ ਸਾਫ ਰੱਖਦੇ ਹਾਂ ਉਸ ਤਰੀਕੇ ਨਾਲ ਸਾਨੂੰ ਆਪਣੇ ਆਲੇ ਦੁਆਲੇ ਅਤੇ ਵਾਤਾਵਰਨ ਦੀ ਵੀ ਰੱਖਿਆ ਕਰਨੀ ਚਾਹੀਦੀ ਹੈ ਸਾਨੂੰ ਆਪਣਾ ਵਾਤਾਵਰਨ ਸਾਫ ਰੱਖਣਾ ਚਾਹੀਦਾ ਹੈ ਜਿਸ ਨਾਲ ਸਾਨੂੰ ਇਕਦਮ ਸ਼ੁੱਧ ਅਤੇ ਤਾਜ਼ਾ ਹਵਾ ਰੋਜ਼ਾਨਾ ਪ੍ਰਾਪਤ ਹੋਵੇਗੀ ਜੰਗਲ ਪੇੜ ਪੌਦੇ ਪਾਣੀ ਮਿੱਟੀ ਇਹ ਸਾ ਸਭ ਸਾਡੇ ਵਾਤਾਵਰਨ ਦੇ ਹੀ ਅੰਗ ਹਨ ਇਹ ਸਭ ਸਾਡਾ ਵਾਤਾਵਰਨ ਵਿੱਚ ਹੀ ਆਉਂਦਾ ਹੈ ਸਾਨੂੰ ਆਪਣੇ ਵਾਤਾਵਰਣ ਨੂੰ ਇਵੇਂ ਸਾਫ ਰੱਖਣਾ ਚਾਹੀਦਾ ਹੈ ਜਿਵੇਂ ਅਸੀਂ ਆਪਣਾ ਘਰ ਰੱਖੀਏ ਰੱਖਿਆ ਹੁੰਦਾ ਹੈ ਸਾਨੂੰ ਆਪਣੇ ਵਾਤਾਵਰਨ ਵਿੱਚ ਕੋਈ ਵੀ ਧੂੰਏ ਪਦਾਰਥ ਅਜੇ ਅਜਿਹੇ ਪਦਾਰਥ ਜਿਸ ਨਾਲ ਸਾਡ ਸਾਨੂੰ ਨੁਕਸਾਨ ਹੋਵੇ ਜਾਂ ਸਾਡੇ ਪੇੜ ਪੌਦਿਆਂ ਨੂੰ ਨੁਕਸਾਨ ਹੋਵੇ ਇਹਦੇ ਨਾਲ ਨਹੀਂ ਕੁਝ ਕਰਨਾ ਚਾਹੀਦਾ

ਅਸੀਂ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਤਾਂ ਬਹੁਤ ਸਾਰੀਆਂ ਸਮੱਸਿਆ ਹਨ ਜਿਵੇਂ ਕਿ ਪਾਣੀ ਪ੍ਰਦੂਸ਼ਣ ਅੱਜ ਕੱਲ੍ਹ ਬਹੁਤ ਫੈਲ ਰਹੀ ਹੈ ਜਲ ਪ੍ਰਦੂ ਪਾਣੀ ਪ੍ਰਦੂਸ਼ਣ ਅੱਗ ਪ੍ਰਦੂਸ਼ਣ ਅੱਗ ਤੋਂ ਨਿਕਲਦੀਆਂ ਲਪਟਾ ਤੇਜ਼ ਲਪਟਾਂ ਜੋ ਕਿ ਸਾ ਧੂ ਧੂੰਏ ਵਿੱਚ ਬਦਲਦੀ ਹਨ ਜੋ ਕਿ ਧੂੰਆਂ ਉੱਪਰ ਜਾਂਦਾ ਹੈ ਕਾਲਾ ਕਾਲਾ ਜਿੰਨਾਂ ਕਾਲਾ ਧੂੰਆਂ ਹੁੰਦਾ ਉਹ ਅਗਰ ਸਾਡੇ ਫੇਫੜਿਆਂ ਵਿੱਚ ਸਾਡੇ ਆਪਾਂ ਸਾਹ ਲੈਂਦੇ ਹਾਂ ਅਤੇ ਉਹ ਸਾਡੇ ਫੇਫੜਿਆਂ ਵਿੱਚ ਜਾਂਦਾ ਹੈ ਅਤੇ ਉਹਦੇ ਨਾਲ ਸਾਨੂੰ ਇੰਨੀ ਕੁ ਮਤਲਬ ਇੰਨੀ ਕੁ ਸਾਨੂੰ ਉਹਦੇ ਨਾਲ ਤਕਲੀਫ ਹੁੰਦੀ ਹੈ ਇਹ ਸਾਨੂੰ ਉਸ ਟ ਉਸ ਸਮੇਂ ਨਹੀਂ ਪਤਾ ਚੱਲਦਾ ਪਰ ਜਦੋਂ ਹੀ ਆਪਾਂ ਕੁਝ ਸਮਾਂ ਬਤੀਤ ਹੁੰਦਾ ਹੈ ਉਹ ਧੂੰਆਂ ਸਾਨੂੰ ਇੰਨਾਂ ਕੁ ਪ੍ਰਭਾਵਿਤ ਕਰਦਾ ਕਿ ਉਹ ਸਾਡੇ ਫੇਫੜਿਆਂ 'ਤੇ ਬਹੁਤ ਗੰਭੀਰ ਅਸਰ ਪਾਉਂਦਾ ਹੈ ਜੇਕਰ ਸਾਡਾ ਜਲ ਪ ਜਲ ਪ੍ਰਦੂਸ਼ਣ ਜੇਕਰ ਆਪਾਂ ਜਲ ਪੀਏ ਉਹ ਦੂਸ਼ਿਤ ਹੋਵੇ ਤਾਂ ਇਹ ਵੀ ਸਾਡੇ ਲਈ ਇੱਕ ਬਹੁਤ ਹੀ ਨੁਕਸਾਨਦਾਇਕ ਚੀਜ਼ ਆ ਇਸ ਲਈ ਸਾਨੂੰ ਆਪਣੇ ਵਾਤਾਵਰਨ ਦੀ ਸੁਰੱਖਿਆ ਕਰਨੀ ਚਾਹੀਦੀ ਹੈ